ਹੈਲੋ ਸਰ ਸਤਿ ਸ਼੍ਰੀ ਅਕਾਲ ਮੈਂ ਗੁਰਦਾਸਪੁਰ ਤੋਂ ਜਗਦੀਸ਼ ਕੁਮਾਰੀ ਬੋਲ ਰਹੀ ਹਾਂ ਮੈਂ ਤੁਹਾਡੇ ਰੈਸਟੋਰੈਂਟ ਤੋਂ ਪਿਛਲੀ ਵਾਰੀ ਚਨੇ ਪੂੜੀਆਂ ਮੰਗਵਾਏ ਸੀ ਪੀਜ਼ਾ ਵੀ ਮੰਗਵਾਇਆ ਸੀ ਜਿਹੜਾ ਕਿ ਸਾਨੂੰ ਬਹੁਤ ਪਸੰਦ ਆਇਆ ਤੁਸੀਂ ਬਹੁਤ ਸੋਹਣੇ ਮਸਾਲੇ ਪਾਏ ਹੋਏ ਸੀ ਸਾਡੇ ਬੱਚਿਆਂ ਨੂੰ ਬਹੁਤ ਰਿਸ਼ਤੇਦਾਰਾਂ ਨੂੰ ਬਹੁਤ ਪਸੰਦ ਆਏ ਸਾਡੇ ਰਿਸ਼ਤੇਦਾਰ ਆਏ ਸੀ ਉਹਨਾਂ ਨੇ ਬਹੁਤ ਤਾਰੀਫ ਕੀਤੀ ਸਾਡ ਤੁਹਾਡੇ ਤੁਹਾਡੇ ਉਹਦੀ ਪੀਜ਼ੇ ਦੀ ਤਾਂ ਕਿ ਉਹ ਮੈਂ ਦੁਬਾਰਾ ਮੰਗਵਾਉਣਾ ਚਾਹੁੰਦੀ ਹਾਂ ਦੁਬਾਰਾ ਮੰਗਵਾਉਣਾ ਚਾਹੁੰਦੀ ਹਾਂ ਅਤੇ ਤੁਸੀਂ ਉਹ ਟਾਈਮ ਨਾਲ ਚੀਜ਼ ਸਾਨੂੰ ਭੇਜਦੇ ਦੇਵੋ ਅਤੇ ਚਨੇ ਪੂੜੀਆਂ ਵੀ ਸਾਨੂੰ ਬਹੁਤ ਪਸੰਦ ਆਈਆਂ ਤੁਹਾਡੀਆਂ ਤੁਹਾਨ ਸਾਨੂੰ ਤੁਹਾਡਾ ਰੇਟ ਬਹੁਤ ਵਧੀਆ ਲੱਗਾ ਇਸ ਕਰਕੇ ਅਸੀਂ ਦੁਬਾਰਾ ਤੁਹਾਡੇ ਕੋਲ ਮੰਗਵਾਉਣਾ ਚਾਹੁੰਦੇ ਹਾਂ ਜੇ ਕੱਲ੍ਹ ਨੂੰ